ਹਾਂਜੀ ਅੱਜ ਪੰਜਾਬੀ ਭਾਸ਼ਾ ਬੋਲਣ ਵਾਲਿਆਂ 'ਤੇ ਚੁਣੌਤੀਆਂ 'ਤੇ ਮੈਂ ਬੋਲਣਾ ਚਾਹੁੰਦੀ ਹਾਂ ਕਿ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਹਨ ਉਹਨਾਂ ਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਕਿਸੇ ਜੋਬ ਲਈ ਜਾਂਦੇ ਹਨ ਉਹਨਾਂ ਨੂੰ ਇੰਟਰਵਿਊ ਵੀ ਹੀ ਇੰਗਲਿਸ਼ ਦੇ ਵਿੱਚ ਹੀ ਕਰਨਾ ਪੈਂਦਾ ਵਾ ਪਰ ਉਹ ਇੰਗਲਿਸ਼ ਨਹੀਂ ਬੋਲ ਪਾਉਂਦੇ ਉਹਨਾਂ ਨੂੰ ਆਪਣੀ ਜੋਬ ਤੋਂ ਵੀ ਹੱਥ ਧੋਣੇ ਪੈਂਦੇ ਹਨ ਕਿਉਂਕਿ ਉਹ ਇੰਨੇ ਹੋਣਹਾਰ ਹੋਣ ਕਰਕੇ ਵੀ ਉਹਨਾਂ ਨੂੰ ਉਹਨਾਂ ਕੋਲ ਇੰਟਰਵਿਊ ਕਲੀਅਰ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੂੰ ਵੀ ਹੀ ਪੰਜਾਬੀ ਪੰਜਾਬੀ ਵਿੱਚ ਹੀ ਇੰਟਰਵਿਊ ਹੋਣਾ ਚਾਹੀਦਾ ਵਾ ਜਿਵੇਂ ਜਿਹੜੇ ਪੰਜਾਬੀ ਬੋਲਦੇ ਹਨ ਉਹਨਾਂ ਨੂੰ ਅਨਪੜ੍ਹ ਹੀ ਸਮਝਿਆ ਜਾਂਦਾ ਵਾ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਦੀ ਜਿਹੜੇ ਪਿਓਰ ਪੰਜਾਬੀ ਬੋਲਦੇ ਹਨ ਠੇਠ ਪੰਜਾਬੀ ਬੋਲਦੇ ਹਨ ਉਹਨਾਂ ਨੂੰ ਹੀ ਅਨਪੜ੍ਹ ਗਵਾਰ ਜਾਣਿਆ ਜਾਂਦਾ ਵਾ ਅਤੇ ਜਿਹੜੇ ਕੋਨਵੇਂਟ ਸਕੂਲ ਆ ਜਿਵੇਂ ਕਿ ਉਹ ਪੰਜਾਬੀ ਨੂੰ ਵਾਧੂ ਵਿਸ਼ਾ ਕਰਕੇ ਹੀ ਪੜ੍ਹਾ ਰਹੇ ਹਨ ਅਤੇ ਪਰ ਇਹੋ ਜਿਹਾ ਚੀਜ਼ ਨਹੀਂ ਹੋਣੀ ਚਾਹੀਦੀ ਸਕੂਲਾਂ ਵਿੱਚ ਕਿਉਂਕਿ ਇਹ ਤਾਂ ਆਪਣੀ ਪੰਜਾਬੀ ਜਿਹੜੀ ਹੈ ਮਾਤ ਭਾਸ਼ਾ ਵਾ ਇਹਨੂੰ ਪਹਿਲ ਦੇ ਅਧਾਰ 'ਤੇ ਹੀ ਰੱਖਿਆ ਜਾਣਾ ਚਾਹੀਦਾ ਹਨ ਅਤੇ ਜਿਵੇਂ ਕਿ ਜਿੱਦਾਂ ਬੱਚਿਆਂ ਨੂੰ ਵੀ ਜ਼ਿਆਦਾ ਸਕੂਲਾਂ ਦੇ ਵਿੱਚ ਇੰਗਲਿਸ਼ ਨੂੰ ਹੀ ਪਹਿਲ ਦਿੱਤੀ ਜਾਂਦੀ ਹਨ ਬੱਚਿਆਂ ਨੂੰ ਵੀ ਪੰਜਾਬੀ ਵੱਲ ਘੱਟ ਹੀ ਘੱਟ ਹੀ ਵੀ ਟੀਚਰ ਜਿਹੜੇ ਆ ਧਿਆਨ ਦੇ ਦਵਾਉਣ ਦਏ ਆ ਬੱਚਿਆਂ ਨੂੰ ਜ਼ਿਆਦਾ ਇੰਗਲਿਸ਼ ਹੀ ਬੋਲਣ ਦੇਣ ਦਏ ਆ ਜਿਵੇਂ ਕਿ ਉਹਨਾਂ ਨੂੰ ਪੰਜਾਬੀ ਭਾਸ਼ਾ ਬੋਲਣ ਤੋਂ ਮਨ੍ਹਾ ਕਰਦੇ ਆ ਵੀ ਤੁਸੀਂ ਪੰਜਾਬੀ ਨਹੀਂ ਸੀ ਬੋਲਣੀ ਤੁਸੀਂ ਇੰਗਲਿਸ਼ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਕਰੋ ਜਿਵੇਂ ਬੱਚਾ ਕੋਈ ਨਹੀਂ ਪੰਜਾਬੀ ਬੋਲ ਪਾਉਂਦਾ ਵਾ ਪਰ ਉਹਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਉਹ ਵੀ ਬੱਚਾ ਜਿਹੜਾ ਵਾ ਵੀ ਉਹਨਾਂ ਦਾ ਵੀ ਮਨ ਨੂੰ ਠੇਸ ਪਹੁੰਚਦੀ ਆ ਵੀ ਸਾਨੂੰ ਜਿਹੜੀ ਸਾਡੀ ਮਾਤ ਭਾਸ਼ਾ ਵਾ ਉਹਨੂੰ ਬੋਲਣ ਤੋਂ ਮਨਾਹੀ ਕਰਦੇ ਹਨ ਇਸ ਕਰਕੇ ਬੱਚਿਆਂ ਨੂੰ ਵੀ ਪੰਜਾਬੀ ਭਾਸ਼ਾ ਬੋਲਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿਹੜੇ ਵ ਹੋਣਹਾਰ ਵਿਦਿਆਰਥੀ ਆ ਉਹਨਾਂ ਨੂੰ ਵੀ ਪੰਜਾਬੀ ਭਾਸ਼ਾ ਬੋਲਣ ਅਤੇ ਜਿਹੜਾ ਵਾ ਵੀ ਉਹਨਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ